ਦੇਖੋ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਅਗਰ ਇਹ ਮੌਕਾ ਦਿੱਤਾ ਜਾਵੇ ਨਾ ਤਾਂ ਮੈਂ ਅਤੇ ਇਹ ਪੰਜਾਬ ਦਾ ਦੇਖੋ ਜਿਵੇਂ ਕਿ ਕਰਨਾਟਕ ਦੇ ਕੱਥਕ ਬੜਾ ਮਸ਼ਹੂਰ ਆ ਗੁਜਰਾਤ ਦਾ ਗਰਬਾ ਮਸ਼ਹੂਰ ਆ ਪੰਜਾਬ ਦੇ ਵਿੱਚ ਤਾਂ ਭੰਗੜਾ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਜੇ ਮੈਨੂੰ ਸਾਨੂੰ ਮੌਕਾ ਦਿੱਤਾ ਜਾਵੇ ਅਤੇ ਪੰਜਾਬ ਦਾ ਦੇਖੋ ਭੰਗੜਾ ਇਸ ਕਰਕੇ ਮਸ਼ ਪੰਜਾਬ ਦਾ ਜਿਹੜਾ ਭੰਗੜਾ ਹੈ ਨਾ ਜੇ ਮੈਂ ਦੂਜੇ ਦੇਸ਼ਾਂ ਨੂੰ ਦਿਖਾਉਣਾ ਚਾਹਵਾਂ ਨਾ ਅਤੇ ਉਹ ਇਸ ਕਰਕੇ ਦਿਖਾਉਣਾ ਚਾਹਵਾਂਗੀ ਕਿ ਉਹ ਜਿਹੜੀ ਸਾਡੇ ਪੰਜਾਬੀ ਜਿਹੜੀ ਹੈਗੀ ਹੈ ਉਹ ਦੂਜੇ ਦੇਸ਼ਾਂ ਦੇ ਵਿੱਚ ਵੀ ਵਿਕਸਿਤ ਹੋ ਸਕੇ ਪੰਜਾਬੀ ਜੀਵਨ ਸ਼ੈਲੀ ਉਹ ਵੀ ਵਰਤਾਅ ਸਕਣ ਜਿਹੜਾ ਉਹਨਾਂ ਦੀ ਸਾਡੀ ਕਲਾ ਵਾ ਪੰਜਾਬ ਦੀ ਉਹ ਉੱਥੇ ਮਸ਼ਹੂਰ ਹੋ ਸਕੇ ਪੰਜਾਬ ਦਾ ਭੰਗੜਾ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਹੁਣ ਗੁਜਰਾਤ ਦਾ ਜਿਵੇਂ ਗਰਬਾ ਵਾ ਉਹ ਆਪਣੀ ਜਗ੍ਹਾ 'ਤੇ ਹੈ ਕਰਨਾਟਕ ਦਾ ਕੱਥਕ ਆਪਣੀ ਜਗ੍ਹਾ 'ਤੇ ਪੰਜਾਬ ਦਾ ਭੰਗੜਾ ਤਾਂ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਦੂਜੇ ਦੇਸ਼ਾਂ 'ਚ ਜਾਣਗੇ ਜਿਹੜੇ ਉੱਥੋਂ ਦੇ ਜਿਹੜੇ ਜਿਵੇਂ ਕਿ ਹੋਰ ਬਾਹਰ ਦੇ ਮਮੈਰੀਕਾ ਹੈ ਜਿਵੇਂ ਕੁਛ ਹੋਰ ਕੋਈ ਦੇਸ਼ ਆ ਉਹ ਆਪਣਾ ਜਿਹੜਾ ਕਲਚਰ ਆ ਉਹ ਪੰ ਉਹ ਬਹੁਤ ਹੀ ਖ਼ਰਾਬ ਹੈ ਅਤੇ ਸੱਭਿਆਚਾਰਕ ਜਿਹੜਾ ਸਾਡਾ ਕਲਚਰ ਆ ਉਹ ਉਥੇ ਅਪਣਾਣਗੇ ਅਤੇ ਉਹਨਾਂ ਦੀ ਜੀਵਨ ਸ਼ੈਲੀ ਚੰਗੀ ਬਣੇਗੀ ਪੰਜਾਬੀਅਤ ਫੈਲੇਗੀ ਪੰਜਾਬ ਦੀ ਕਲਾ ਸ਼ੈਲੀ ਫੈਲੇਗੀ ਪੰਜਾਬ ਦਾ ਕਲਿਆਣ ਹੋਏਗਾ ਦੇਸ਼ ਦਾ ਕਲਿਆਣ ਹੋਏਗਾ